ਘਰ ਵਿੱਚ ਬਗੀਚੀ ਦੀ ਸਾਂਭ ਸੰਭਾਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਕੋਈ ਇਨਸਾਨ ਆਪਣੇ ਸਰੀਰ ਦੀ ਸਫ਼ਾਈ ਕਰਦਾ ਹੈ ਉਸ ਪ੍ਰਕਾਰ ਸਾਨੂੰ ਇਹਨਾਂ ਪੌ ਪੇੜ ਪੌਦਿਆਂ ਦੀ ਵੀ ਸਫ਼ਾਈ ਕਰਨੀ ਜ਼ਰੂਰੀ ਹੈ ਪਰ ਇਹਦੇ ਵਿੱਚ ਕੁਝ ਖਾਸ ਖਰਚਾ ਨਹੀਂ ਆਉਂਦਾ ਕਿਉਂਕਿ ਸਾਨੂੰ ਲੋੜੀਂਦੀ ਸਮਾਨ ਘਰ ਤੋਂ ਹੀ ਪ੍ਰਾਪਤ ਹੋ ਜਾਂਦਾ ਹੈ ਜਿਵੇਂ ਕਿ ਪਾਣੀ ਪਾਉਣਾ ਪੌਦਿਆਂ ਨੂੰ ਇਹਨਾਂ ਦੀ ਕਟਾਈ ਕਰਨੀ ਪਰ ਕੁਝ ਪੇੜ ਪੌਦੇ ਐਵੇਂ ਦੇ ਵੀ ਹੁੰਦੇ ਹਨ ਜਿਨ੍ਹਾਂ ਦੀ ਕਟਾਈ ਕਰਨੀ ਜ਼ਰੂਰੀ ਨਹੀਂ ਹੁੰਦੀ ਪਰ ਉਹਨਾਂ ਨੂੰ ਸਮੇਂ ਸਿਰ ਖਾਦ ਪਾਣੀ ਪਾਣੀ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਹੁਣ ਸਾਨੂੰ ਖਾਦ ਲਈ ਕਿਤੇ ਬਾਹਰ ਦੂਰ ਜਾਣ ਦੀ ਲੋੜ ਨਹੀਂ ਹੁੰਦੀ ਇਹ ਸਾਨੂੰ ਪਿੰਡਾਂ ਵਿੱਚ ਤਾਂ ਆਮ ਤੌਰ 'ਤੇ ਮਿਲ ਹੀ ਜਾਂਦੀ ਹੈ ਜਿਵੇਂ ਕਿ ਮੱਝਾਂ ਦਾ ਗੋਹਾ ਹੁੰਦਾ ਹੈ ਉਸ ਦੀ ਖਾਦ ਬਣਾਈ ਜਾਂਦੀ ਹੈ ਅਤੇ ਇਸਨੂੰ ਹੀ ਪੌਦਿਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਡੀ ਕੰਪੋਸਟ ਦੀ ਖਾਦ ਵਰਤੀ ਜਾਂਦੀ ਹੈ ਇਸ ਪ੍ਰਕਾਰ ਹੋਰ ਕਾਫ਼ੀ ਜ਼ਿਆਦਾ ਸਾਰੀਆਂ ਚੀਜ਼ਾਂ ਜੋ ਸਾਨੂੰ ਪਿੰਡਾਂ ਵਿੱਚ ਹੀ ਮਿਲ ਜਾਂਦੀਆਂ ਹਨ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਹੈ ਅਤੇ ਇਸ 'ਤੇ ਕੁਛ ਵਾਧੂ ਖਰਚਾ ਕਰਨ ਦੀ ਲੋੜ ਨਹੀਂ ਪੈਂਦੀ ਹੈ ਇਸ ਕਰਕੇ ਪੌਦਿਆਂ ਨੂੰ ਵੀ ਇੱਕ ਚੰਗੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਕੋਈ ਸ ਮਹਿੰਗਾ ਸੌਦਾ ਨਹੀਂ ਹੈ